ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਨੂੰ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ ਜਿੱਥੇ ਹਰ ਇੱਕ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਸਾਰੇ ਲੋਕ ਇਸ ਤਿਉਹਾਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਇਸ ਤਿਉਹਾਰ ਵਿੱਚ ਆਪਣੀ ਖੁਸ਼ੀ ਪ੍ਰਗਟ ਕਰਦੇ ਹਨ ਪੰਜਾਬ ਨੂੰ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ ਜਿੱਥੇ ਕਿ ਹੋਲੀ ਦੀਵਾਲੀ ਵਿਸਾਖੀ ਸਾਰੇ ਲੋਕ ਬੜੀ ਧੂਮਧਾਮ ਅਤੇ ਖੁਸ਼ੀ ਨਾਲ ਮਨਾਉਂਦੇ ਹਨ ਹੋਲੀ ਨੂੰ ਵੀ ਲੋਕ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ ਜਿੱਥੇ ਕਿ ਕਈ ਲੋਕ ਬਾਹਰ ਜਾ ਕੇ ਇੱਕ ਦੂਜੇ ਨੂੰ ਰੰਗ ਲਾਉਂਦੇ ਹਨ ਆਪਣੀ ਖੁਸ਼ੀ ਪ੍ਰਗਟ ਕਰਦੇ ਹਨ ਅਤੇ ਤੁਸੀਂ ਵੇਖ ਸਕਦੇ ਹੋ ਕਿ ਕਈ ਲੋਕ ਬਾਹਰ ਜਾ ਕੇ ਆਪਣੇ ਦੋਸਤਾਂ ਨਾਲ ਕਿਸੇ ਥਾਂ 'ਤੇ ਉੱਤੇ ਮਿਲਜੁਲ ਕੇ ਹੋਲੀ ਖੇਡਦੇ ਹਨ ਜਿੱਥੇ ਉਹ ਡਾਂਸ ਮਸਤੀ ਫਨ ਵਗੈਰਾ ਕਰਦੇ ਹਨ ਅਤੇ ਦੀਵਾਲੀ ਵਿੱਚ ਦੀਵਾਲੀ ਨੂੰ ਖੁਸ਼ੀਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਅਤੇ ਉਹ ਹਰ ਇੱਕ ਘਰ ਵਿੱਚ ਖੁਸ਼ੀ ਲੈ ਕੇ ਆਉਂਦਾ ਹੈ ਜਿੱਥੇ ਕਿ ਦੀਵਾਲੀ ਵਿੱਚ ਸਾਨੂੰ ਸਾ ਸਾਡੇ ਘਰ ਵਿੱਚ ਦੀਵੇ ਜਲਾਏ ਜਾਂਦੇ ਹਨ ਜੋ ਕਿ ਖੁਸ਼ੀ ਦਾ ਪ੍ਰਤੀਤ ਦਿੰਦੇ ਹਨ ਅਤੇ ਕਈ ਲੋਕ ਪਟਾਕੇ ਵੀ ਫੋੜਦੇ ਹਨ ਬਟ ਕਿਹਾ ਜਾਂਦਾ ਹੈ ਕਿ ਪਟਾਕੇ ਸਾਨੂੰ ਨਹੀਂ ਫੋੜਨੇ ਚਾਹੀਦੇ ਹਨ ਕਿਉਂਕਿ ਪਟਾਕੇ ਫੋੜਨ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਅਤੇ ਸਾਨੂੰ ਸਿਰਫ ਦੀਯਾਂ ਨਾਲ ਹੀ ਮਨਾਉਣੀ ਚਾਹੀਦੀ ਹੈ ਦੀਵਾਲੀ ਤਾਂ ਕਿ ਜੋ ਵਾਤਾਵਰਣ ਨੂੰ ਵੀ ਇਸਦਾ ਨੁਕਸਾਨ ਨਾ ਪਹੁੰਚੇ ਅਤੇ ਅਸੀਂ ਸਾਰੇ ਮਿਲਜੁਲ ਕੇ ਇਹ ਪਰਿਵਾਰ ਚੰਗੇ ਤਰੀਕੇ ਨਾਲ ਮਨਾਏ ਅਤੇ ਕਈ ਲੋਕ ਘਰ ਜਾ ਕੇ ਮਿਠਾਈਆਂ ਵੀ ਵੰਡਦੇ ਹਨ ਅਤੇ ਇਸ ਤੋਂ ਬਾਅਦ ਬਹੁਤ ਸਾਰੇ ਤਿਉਹਾਰ ਹਨ ਜੋ ਲੋਕ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ ਇਹ ਸਾਰੇ ਈਵਨ ਕਿ ਬਾਹਰਲੇ ਦੇਸ਼ਾਂ ਤੋਂ ਵੀ ਲੋਕ ਪੰਜਾਬ ਆਉਂਦੇ ਹਨ ਕਿ ਉਹ ਤਿਉਹਾਰ ਮਨਾਉਣ ਆ ਤਿਉਹਾਰ ਮਨਾਉਣ ਆਏ ਆਉਣ ਇੱਥੇ ਪੰਜਾਬ ਵਿੱਚ ਕਿਉਂਕਿ ਪੰਜਾਬ ਨੂੰ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ